ਮੈਂ ਫਿਲਮਾਂ ਬਹੁਤ ਦੇਖਦਾ ਹਾਂ ਗਾਣੇ ਵੀ ਬਹੁਤ ਸੁਣਦਾ ਹਾਂ ਹਿੰਦੀ ਫਿਲਮਾਂ ਵਿੱਚ ਸੰਨੀ ਦਿਓਲ ਦੀ ਫਿਲਮਾਂ ਮੈਨੂੰ ਬਹੁਤ ਪਸੰਦ ਹਨ ਉਸਦੀ ਐਕਟਿੰਗ ਬੜੀ ਜਬਰਦਸਤ ਹੁੰਦੀ ਹੈ ਔਰ ਉਸਦਾ ਰੌਲ ਕਾਫ਼ੀ ਵਧੀਆ ਲੱਗਦਾ ਹੈ ਪੰਜਾਬੀ ਫਿਲਮਾਂ ਵਿੱਚ ਦਲਜੀਤ ਦੋਸਾਂਝ ਦੀਆਂ ਫਿਲਮਾਂ ਬਹੁਤ ਪਸੰਦ ਹਨ ਉਨ੍ਹਾਂ ਦੀ ਐਕਟਿੰਗ ਬੜੀ ਜਬਰਦਸਤ ਹੁੰਦੀ ਹੈ ਔਰ ਉਹਨਾਂ ਦੀ ਫਿਲਮਾਂ ਵਿੱਚ ਕਾਫ਼ੀ ਵਧੀਆ ਰੌਲ ਕੀਤਾ ਹੁੰਦਾ ਹੈ